ਖੇਡਾਂ ਲਈ ਪੇਂਡੂ ਲੋਕਾਂ ਦੇ ਕਾਫੀ ਵਧੀਆ ਵਿਚਾਰ ਨੇ ਪੇਂਡੂ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਹੜੇ ਲੋਕ ਖੇਡਦੇ ਨੇ ਉਹ ਮਾਨਸਿਕ ਤੌਰ 'ਤੇ ਅਤੇ ਸਰੀਰਿਕ ਤੌਰ 'ਤੇ ਕਾਫੀ ਵਧੀਆ ਰਹਿੰਦੇ ਨੇ ਖੇਡਾਂ ਦਾ ਉਹਨਾਂ 'ਤੇ ਪ੍ਰਭਾਵ ਸਰੀਰ 'ਤੇ ਅਤੇ ਮਾਨਸਿਕ ਵਧੀਆ ਪੈਂਦਾ ਹੈ ਉਹ ਵਧੀਆ ਤਰੀਕੇ ਦੀ ਸੋਚ ਪਾਉਂਦੇ ਨੇ ਉਨਦੇ ਵਿਚਾਰ ਵੀ ਕਾਫੀ ਵਧੀਆ ਰਹਿੰਦੇ ਨੇ ਉਹਨਾਂ ਨੂੰ ਕੋਈ ਐਨਜਾਈਟੀ ਅਤੇ ਸਟਰੈਸ ਦਾ ਕੁਛ ਨਹੀਂ ਹੁੰਦਾ ਅਤੇ ਉਹ ਸਰੀਰੋਂ ਵੀ ਵਧੀਆ ਰਹਿੰਦੇ ਨੇ ਕਾਫੀ ਵਧੀਆ ਕਸਰਤ ਕਰਦੇ ਨੇ ਜਿਸ ਨਾਲ ਉਹਨਾਂ ਦਾ ਸਰੀਰ ਖੁੱਲ੍ਹਾ ਰਹਿੰਦਾ ਹੈ ਅਤੇ ਪਿੰਡਾਂ 'ਚ ਤਾਂ ਸਰੀਰ ਨੂੰ ਹੀ ਮਹੱਤਵ ਦਿੱਤਾ ਜਾਂਦਾ ਹੈ ਅਤੇ ਸਰੀਰ ਹੀ ਸਭ ਕੁਛ ਮੰਨਦੇ ਨੇ ਉਹ ਕਿਉਂਕਿ ਜੇ ਬੰਦੇ ਦਾ ਸਰੀਰ ਹੈ ਤਾਂ ਹੀ ਉਹ ਵਧੀਆ ਜੀ ਪਾਏਗਾ ਸੋਚ ਪਾਏਗਾ ਅਤੇ ਪੜ੍ਹ ਪਾਏਗਾ ਅਤੇ ਕਮਾ ਪਾਏਗਾ ਆਪਣੇ ਲਈ ਹੁਣ ਜਿੱਦਾਂ ਪਿੰਡਾਂ 'ਚ ਕਈ ਤਰ੍ਹਾਂ ਦੇ ਖੇਡਾਂ ਕੀਤੀਆਂ ਜਾਂਦੀਆਂ ਹਨ ਸਭ ਤੋਂ ਮਹੱਤਵਪੂਰਨ ਉਹ ਕਸਰਤ ਕਰਦੇ ਨੇ ਅਤੇ ਇਸ ਤੋਂ ਬਾਅਦ ਕਬੱਡੀ ਵਗੈਰਾ ਵੀ ਖੇਡਦੇ ਨੇ ਹੁਣ ਜਿੱਦਾਂ ਆਪਾਂ ਦੇਖੀ ਜਾਈਏ ਪੁਰਾਣੇ ਜ਼ਮਾਨੇ 'ਚ ਕੁਸ਼ਤੀ ਵਗੈਰਾ ਕਾਫੀ ਕੀਤੀ ਜਾਂਦੀ ਸੀ ਅਤੇ ਕੁਸ਼ਤੀ ਵਿੱਚ ਪਹਿਲਵਾਨ ਇੱਕ ਜਗ੍ਹਾ 'ਤੇ ਜਾਂਦਾ ਸੀ ਅਤੇ ਅਪ ਝੰਡਾ ਗਾਡ ਦਿੰਦਾ ਅਤੇ ਉੱਥੇ ਜਾ ਕੇ ਜਿਹੜਾ ਵੀ ਉਸਨੂੰ ਹਰਾ ਕੇ ਦਿੰਦਾ ਅਤੇ ਝੰਡਾ ਅਤੇ ਫਿਰ ਪਹਿਲਵਾਨ ਉੱਥੋਂ ਚਲਾ ਜਾਂਦਾ ਸੀ ਅਤੇ ਜੇ ਦੇਖਿਆ ਜਾਏ ਤਾਂ ਪਹਿਲਾਂ ਜ਼ਮਾਨੇ 'ਚ ਤਾਂ ਪਿੰਡ ਵਾਲੇ ਵੀ ਪਹਿਲਵਾਨ ਕਾਫੀ ਕੁਝ ਖਿਲਾਉਂਦੇ ਪਿਲਾਉਂਦੇ ਸੀ ਅਤੇ ਉਸਦੀ ਕਾਫੀ ਸੇਵਾ ਸੰਭਾਲ ਕਰਦੇ ਸੀ ਇਸ ਲਈਏ ਮੈਂ ਤਾਂ ਇਹ ਮੇਰਾ ਤਾਂ ਇਹੀ ਮੰਨਣਾ ਹੈ ਕਿ ਖੇਡਾਂ ਵਿੱਚ ਪੇਂਡੂ ਲੋਕਾਂ ਦੀ ਕਾਫੀ ਰੁਚੀ ਹੈ ਅਤੇ ਉਹ ਇਸ ਨੂੰ ਕਾਫੀ ਵਧੀਆ ਮਹੱਤਵਪੂਰਨ ਦਿੰਦੇ ਨੇ